ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ ਲੋਕਲ ਪਹਿਰਾਵੇ ਜਿਵੇਂ ਕਿ ਕਰਤੀਆਂ ਚੂਲੀਦਾਰ ਅਤੇ ਸਜੇਤਾਂ ਪਹਿਨੇ ਜਾਂਦੇ ਹਨ ਇਹ ਪੌਸ਼ਾਕਾਂ ਰੰਗੀਨ ਅਤੇ ਚਮਕਦਾਰ ਹੁੰਦੀਆਂ ਹਨ ਜੋ ਡਾਂਸ ਕਰਨ ਵਾਲਿਆਂ ਨੂੰ ਹੋਰ ਆਕਰਸ਼ਿਤ ਬਣਾਉਂਦੀਆਂ ਹਨ ਇਹਨਾਂ ਦੇ ਨਕਸ਼ੇ ਅਤੇ ਸਜਾਵਟ ਡਾਂਸ ਅਤੇ ਮੂੜ ਨੂੰ ਪ੍ਰਕਾਸ਼ਿਤ ਕਰਦੇ ਹਨ ਅਤੇ ਚੱਲਣ ਫਿਰਨ ਦੇ ਦੌਰਾਨ ਢੰਗ ਅਤੇ ਲਹਿਰਾਂ ਨੂੰ ਵਧਾਉਂਦੇ ਹਨ ਇਸ ਨਾਲ ਸਾਥ ਹੀ ਇਸ ਖੇਤਰ ਦੀ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਵੀ ਦਰਸਾਇਆ ਜਾਂਦਾ ਹੈ ਭੰਗੜੇ ਦੇ ਪ੍ਰਦਰਸ਼ਨ ਲਈ ਪਹਿਰਾਵੇ ਦੀਆਂ ਚੋਣਾਂ ਸਿਰਫ ਰੰਗਾਂ ਅਤੇ ਡਿਜ਼ਾਇਨਰ ਨਾਲ ਹੀ ਨਹੀਂ ਸੰਬੰਧਿਤ ਹਨ ਬਲਕਿ ਕੁਝ ਮਹੱਤਵਪੂਰਨ ਅੰਗਾਂ ਨੂੰ ਵੀ ਦਰਸਾਇਆ ਜਾਂਦਾ ਹੈ ਪਹਿਰਾਵੇ ਦੇ ਤੱਤ ਕਰਤੀਆਂ ਇਹ ਆਮ ਤੌਰ 'ਤੇ ਰੰਗੀਨ ਅਤੇ ਚਮਕਦਾਰ ਹੁੰਦੀਆਂ ਹਨ ਜੋ ਡਾਂਸ ਦੇ ਦੌਰਾਨ ਚਮਕਦਾਰ ਲੱਗਦੀਆਂ ਹਨ ਇਹਨਾਂ ਨੂੰ ਲਾਈਟ ਫੈਬਰਿਕ ਪਰਤਿਆਂ ਨਾਲ ਨ੍ਰਿਤਕਾਂ ਨੂੰ ਸੁਵਿਧਾ ਮਿਲਦੀ ਹੈ ਝੂਲੀ ਦਾਲ ਇਹ ਪਹਿਰਾਵੇ ਪੈਰਾਂ ਦੀ ਆਜ਼ਾਦੀ ਨੂੰ ਯਕੀਨੀ ਬਣਾਉਂਦੇ ਹਨ ਜਿਸ ਨਾਲ ਡਾਂਸ ਦੇ ਕਦਮ ਬਹੁਤ ਸੁੰਗਮ ਹੁੰਦੇ ਹਨ ਪੰਨੀਆਂ ਅਤੇ ਸਜੇਤਾ ਇਹ ਸਜਾਵਟ ਡਾਂਸ ਵਿੱਚ ਨੂੰ ਵਧਾਈਆਂ ਜਾਂਦੀਆਂ ਹਨ ਜਦੋਂ ਕਿ ਇਹ ਰੰਗ ਬਿਰੰਗੀ ਸਥਿਤੀਆਂ ਵਿੱਚ ਔਰਤਾਂ ਲਈ ਖਾਸ ਤੌਰ 'ਤੇ ਲੁਕਾਉਂਦੀਆਂ ਹਨ ਰੰਗਾਂ ਦਾ ਮਹੱਤਵ ਭੰਗੜਾ ਡਾਂਸ ਅਤੇ ਰੰਗਾਂ ਦਾ ਚੁਣਾਵ ਵੀ ਮਹੱਤਵਪੂਰਨ ਹੈ ਚਮਕਦਾਰ ਰੰਗਾਂ ਜਿਵੇਂ ਕਿ ਲਾਲ ਹਰਾ ਨੀਲਾ ਅਤੇ ਪੀਲਾ ਜੋਸ਼ ਅਤੇ ਉਤਸਾਹ ਨੂੰ ਦਰਸਾਉਂਦੇ ਹਨ ਇਹ ਰੰਗ ਮੂੜ ਨੂੰ ਉੱਚਾ ਕਰਦੇ ਹਨ ਅਤੇ ਪੂਰੇ ਪ੍ਰਦਰਸ਼ਨ ਵਿਚ ਜੀਵੰਤਤਾ ਪੈਦਾ ਕਰਦੇ ਹਨ ਸੰਸਕ੍ਰਿਤਿਕ ਪ੍ਰਤੀਕ ਪਹਿਰਾਵੇ ਸਿਰਫ ਸੁੰਦਰਤਾ ਨਹੀਂ ਸਗੋਂ ਸੰਸਕ੍ਰਿਤਿਕ ਵਿਰਾਸਤ ਦਾ ਪ੍ਰਤੀਕ ਹੁੰਦੇ ਹਨ ਜੀ ਇਹ ਨ੍ਰਿਤਕਾਂ ਦੀ ਪਰੰਪਰਾਗਤ ਧਾਰਨਾਵਾਂ ਨੂੰ ਉਜਾਗਰ ਕਰਦੇ ਹਨ ਅਤੇ ਲੋਕਾਂ ਨੂੰ ਆਪਣੇ ਨਾਲ ਜੋੜਦੇ ਹਨ ਆਕਰਸ਼ਿਕਤਾ ਭੰਗੜੇ ਦੇ ਸਟਾਈਲ ਅਤੇ ਸਜਾਵਟ ਨਾਲ ਡਾਂਸ ਕਰਨ ਵਾਲੇ ਹੋਰ ਆਕਰਸ਼ਿਤ ਅਤੇ ਮਨਮੋਹਕ ਬਣ ਜਾਂਦੇ ਹਨ ਪਹਿਰਾਵੇ ਦੀ ਲਹਿਰ ਜੋ ਨੱਚਣ ਵਾਲੀਆਂ ਦੀ ਹਰ ਇੱਕ ਹਿਲਦੇ ਮੋੜ ਨਾਲ ਹੋਰ ਚਮਕੀਲੀ ਹੋ ਜਾਂਦੀ ਹੈ ਇਹਨਾਂ ਨੂੰ ਇੱਕ ਮਨਕੋਨ ਹਵਾਈ ਅਤੇ ਜੀਵ ਬੰਦ ਅਨੁਭਵ ਦਿੰਦੀ ਹੈ ਇਸ ਤਰ੍ਹਾਂ ਭੰਗੜਾ ਪ੍ਰਦਰਸ਼ਨ ਵਿੱਚ ਪਹਿਰਾਵਾ ਸਿਰਫ ਇੱਕ ਕੱਪੜਾ ਨਹੀਂ ਬਲਕਿ ਇਹ ਉਤਸ਼ਾਹ ਸੰਸਕ੍ਰਿਤਿਕ ਪਛਾਣ ਅਤੇ ਦਰਸ਼ਕਾਂ ਨੂੰ ਖਿੱਚਣ ਦਾ ਇੱਕ ਮਾਧਿਅਮ ਬਣਦਾ ਹੈ ਦਰਸ਼ਕਾਂ ਦੀਆਂ ਪੂਰੀਆਂ ਨਜ਼ਰਾਂ ਨੂੰ ਖਿੱਚਦੀਆਂ ਹਨ